ਹੈਲੋ ਸਰ ਸਤਿ ਸ਼੍ਰੀ ਅਕਾਲ ਤੁਸੀਂ ਸਨੀ ਟਰੈਵਲ ਤੋਂ ਬੋਲਦੇ ਹੋ ਸਰ ਮੈਂ ਤੁਹਾਡੀ ਕੈਬ ਬੁੱਕ ਕੀਤੀ ਸੀ ਕੱਲ੍ਹ ਮੈਂ ਆਪਣੇ ਪਰਿਵਾਰ ਨਾਲ ਰੇਲਵੇ ਸਟੇਸ਼ਨ ਪਹੁੰਚਣਾ ਹੈ ਤੁਹਾਡੀ ਕੈਬ ਮੇਰੇ ਕੋਲ ਸਹੀ ਸਮੇਂ 'ਤੇ ਪਹੁੰਚ ਜਾਵੇ ਤਾਂ ਕਿ ਮੈਂ ਆਪਣੇ ਪਰਿਵਾਰ ਨਾਲ ਜਿੱਥੇ ਘੁੰਮਣ ਦਾ ਪਲੈਨ ਬਣਾਇਆ ਹੈ ਉੱਥੇ ਜਲਦੀ ਹੀ ਪਹੁੰਚ ਸਕੀਏ ਅਸੀਂ ਤੁਹਾਡੇ ਤੋਂ ਹੀ ਕੈਬ ਬੁੱਕ ਕਰਵਾਉਂਦੇ ਹਾਂ ਤੁਹਾਡਾ ਡਰਾਈਵਰ ਸਾਨੂੰ ਸਹੀ ਸਮੇਂ 'ਤੇ ਪਹੁੰਚਾ ਦਿੰਦਾ ਹੈ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਸਾਨੂੰ ਕੱਲ੍ਹ ਸਹੀ ਸਮੇਂ 'ਤੇ ਕੈਬ ਪਹੁੰਚਾਉਣ ਦੀ ਕਿਰਪਾਲਤਾ ਕਰੋ ਧੰਨਵਾਦ